ਪੇਂਡੂ ਭਾਈਚਾਰੇ ਵਿੱਚ ਖੇਤੀਬਾੜੀ ਇੱਕ ਬਹੁਤ ਹੀ ਮਨ ਪਸੰਦ ਦਾ ਕਿੱਤਾ ਹੈ ਜ਼ਿਆਦਾਤਰ ਲੋਕ ਪਿੰਡ ਵਿੱਚ ਖੇਤੀਬਾੜੀ 'ਤੇ ਨਿਰਭਰ ਹਨ ਖੇਤੀਬਾੜੀ ਵਿੱਚ ਉਹ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਉਗਾ ਕੇ ਆਪਣਾ ਜੀਵਨ ਦਾ ਨਿਰਵਾਹ ਕਰਦੇ ਹਨ ਦੇਖਿਆ ਜਾਵੇ ਤਾਂ ਸਾਡੇ ਬਜ਼ੁਰਗ ਖੇਤੀਬਾੜੀ ਲਈ ਬਲਦਾਂ ਨੇਰ ਬਲਦਾਂ ਨਾਲ ਖੇਤੀ ਕਰਦੇ ਸਨ ਉਸ ਤੋਂ ਬਾਅਦ ਜਿਵੇਂ ਜਿਵੇਂ ਤਕਨੀਕ ਦਾ ਵਿਕਾਸ ਹੁੰਦਾ ਹੈ ਅਤੇ ਨੌਜਵਾਨ ਪੀੜ੍ਹੀ ਅੱਗੇ ਆਉਂਦੀ ਹੈ ਅਤੇ ਨੌਜਵਾਨ ਪੀੜ੍ਹੀ ਟਰੈਕਟਰ ਲੈ ਕੇ ਆਉਂਦੀ ਟਰੈਕਟਰ ਨਾਲ ਖੇਤੀ ਟਰੈਕਟਰ ਤੋਂ ਬਾਅਦ ਜਦੋਂ ਅਸੀਂ ਟਰੈਕਟਰ ਨਾਲ ਖੇਤੀ ਕਰਦੇ ਸਨ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਸੰਦ ਹੁੰਦੇ ਸਨ ਜਿਵੇਂ ਹਾਲਾਂ ਹੋ ਗਈਆਂ ਸੁਹਾਗਾ ਹੋ ਗਿਆ ਪਰ ਵਰਤਮਾਨ ਦੌਰ ਵਿੱਚ ਨੌਜਵਾਨ ਬਿਜਲੀ ਹੁਣ ਇੱਕੋ ਹੀ ਸੰਦ ਆ ਚੁੱਕਾ ਹੈ ਸੁਪਰ ਸੀਡਰ ਜਾਂ ਰੋਟਾਵੇਟਰ ਇਸ ਸੰਦ ਸਾਰੀਆਂ ਹੀ ਹਲਾਂ ਸੁਹਾਗੇ ਨੂੰ ਸਾਰੇ ਨੂੰ ਇੱਕ ਵਾਰੀ ਇਹਨਾਂ ਤੋਂ ਬਿਨਾਂ ਹੀ ਸਾਰ ਲਿਆ ਜਾਂਦਾ ਹੈ ਅਤੇ ਖੇਤੀਬਾੜੀ ਕਰ ਲਈ ਜਾਂਦੀ ਹੈ ਇਸ ਤਰ੍ਹਾਂ ਹੀ ਜਿਹੜੀ ਨੌਜਵਾਨ ਬਜ਼ੁਰਗਾਂ ਨੂੰ ਦੇਖਿਆਂ ਬਲਦਾਂ ਨਾਲ ਸਾਰਾ ਦਿਨ ਖੇਤੀਬਾੜੀ ਵਿੱਚ ਲੱਗੇ ਰਹਿੰਦੇ ਸਨ ਪਰ ਅੱਜ ਕੱਲ੍ਹ ਨੌਜਵਾਨ ਪੀੜੀ ਕੀ ਕਰਦੀ ਉਹ ਤਕਨੀਕ ਨਾਲ ਦਿਮਾਗ ਨਾਲ ਖੇਤੀ ਕਰਕੇ ਜਿੱਥੇ ਇੱਕ ਤਾਂ ਉਪਜ ਵਧੇਰੇ ਲੈ ਰਹੀ ਹੈ ਅਤੇ ਜਲਦ ਸਮੇਂ ਦੀ ਵੀ ਬਚਤ ਕਰ ਰਹੀ ਹੈ ਸਮੇਂ ਦੀ ਬਚਤ ਦੇ ਨਾਲ ਨਾਲ ਵਧੇਰੀ ਉਪਜ ਅਤੇ ਦਿਮਾਗ ਦੀ ਵਰਤੋਂ ਕਰਕੇ ਤਕਨੀਕ ਦੀ ਵਰਤੋਂ ਕਰਕੇ ਆਪਣੀ ਮਿਹਨਤ ਜੋ ਮਿਹਨਤ ਪੁਰਾਣੇ ਬਜ਼ੁਰਗ ਆਪਣੇ ਹੱਥਾਂ ਨਾਲ ਜਾਂ ਵਾਹਨ ਕਰਦੇ ਸਨ ਅੱਜ ਕੱਲ੍ਹ ਇਹ ਦਿਮਾਗ ਨਾਲ ਕਰ ਰਹੇ ਨੇ ਦਿਮਾਗ ਨਾਲ ਕਰਕੇ ਜਿੱਥੇ ਸੁਪਰ ਸੀਡਰ ਵਰਗੀਆਂ ਨਵੀਆਂ ਤਕਨੀਕਾਂ ਲਾ ਕੇ ਡੈੱਲ ਮਸ਼ੀਨ ਵਰਗੀਆਂ ਸਭ ਨਵੀਆਂ ਤਕਨੀਕਾਂ ਲੈ ਕੇ ਖੇਤੀ ਨੂੰ ਇੱਕ ਲਾਹੇਵੰਦਾ ਧੰਦਾ ਬਣਾਇਆ ਜਾ ਰਿਹਾ ਇਸ ਨਾਲ ਹੀ ਨੌਜਵਾਨ ਜਿਹੜੀ ਪੀੜ੍ਹੀ ਅੱਜ ਕੱਲ੍ਹ ਨੌਜਵਾਨ ਪੀੜੀ ਖੇਤੀਬਾੜੀ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਵੀ ਕਰ ਰਹੀ ਹੈ ਜਿਵੇਂ ਡੇਰੀ ਫਾਰਮ ਹੋ ਗਿਆ ਬੱਕਰੀ ਪਾਲਣ ਹੋ ਗਿਆ ਮੁਰਗੀ ਪਾਲਣ ਹੋ ਗਿਆ ਜਹਾਂ ਸ਼ਹਿਦ ਦੀਆਂ ਮੱਖੀਆਂ ਦਾ ਪਾਲਣ ਹੋ ਗਿਆ ਇਹ ਸਾਰੇ ਖੇਤੀ ਬਾੜੀ ਦੇ ਸਹਾਇਕ ਧੰਦੇ ਹਨ ਨੌਜਵਾਨ ਪੀੜ੍ਹੀ ਇਹਨਾਂ ਨੂੰ ਨਾਲ ਲੈ ਕੇ ਖੇਤੀਬਾੜੀ ਵਿੱਚ ਵਧੇਰੀ ਉਪਜ ਵਧੇਰੇ ਉਪਜ ਵਧੇਰੇ ਲਾਹਾ ਵਧੇਰੇ ਕਮਾਈ ਪ੍ਰਾਪਤ ਕਰ ਰਹੀ ਹੈ ਸ਼ੁਕਰੀਆ